ਇਹਨਾਂ ਖਿੱਤਿਆਂ ਦੇ ਵਿਦਿਆਰਥੀ ਨੇ ਜਿਹੜੇ ਸਕੂਲਾਂ ਵਿੱਚ ਦੌੜਨ ਵਿੱਚ ਬਿਲਕੁਲ ਰੁੱਝੇ ਹੋਏ ਨੇ ਕਿਉਂਕਿ ਹੁਣ ਕੀ ਹੈ ਵੀ ਅੱਜ ਕੱਲ੍ਹ ਜਿਹੜੇ ਆਪਣੇ ਮਾਤਾ ਪਿਤਾ ਨੇ ਹੈ ਨਾ ਉਹ ਵੀ ਮਤਲਬ ਕਿ ਇਸ ਚੀਜ਼ ਤੋਂ ਜਾਗਰੂਕ ਹੋ ਗਏ ਨੇ ਕਿ ਸਿਹਤਮੰਦ ਬੱਚਾ ਰਹੂਗਾ ਤਾਂ ਨਾ ਵੀ ਉਹ ਕਿਤੇ ਵੀ ਮਾਰ ਨਹੀਂ ਖਾਂਦਾ ਹੈਗਾ ਜੇ ਸਿਹਤ ਆ ਤਾਂ ਹੀ ਜਹਾਨ ਆ ਅੱਗੇ ਤਾਂ ਹੁਣ ਕੀ ਹੈ ਵੀ ਜਿਵੇਂ ਆਪਾਂ ਕਹਿ ਸਕਦੇ ਹਾਂ ਵੀ ਹੁਣ ਸਕੂਲਾਂ ਦੇ ਵਿੱਚ ਹੈ ਨਾ ਸਰਕਾਰੀ ਸਕੂਲ ਜਾਂ ਪ੍ਰਾਈਵੇਟ ਸਕੂਲ ਕਹਿ ਲਓ ਤੁਸੀਂ ਹੈ ਨਾ ਵੀ ਓਥੇ ਇਨ੍ਹਾਂ ਨੇ ਹੁਣ ਇਹ ਲਾਜ਼ਮੀ ਕਰਤਾ ਵੀ ਇੱਕ ਗੇਮ ਤਾਂ ਹੋਣੀ ਹੀ ਚਾਹੀਦੀ ਹੈ ਬੱਚਿਆਂ ਨੂੰ ਤਾਂ ਮੇਰੇ ਹਿਸਾਬ ਨਾਲ ਤਾਂ ਇਹ ਚੀਜ਼ ਜੇ ਇੱਕ ਬੱਚਾ ਗੇਮ ਕੋਈ ਵੀ ਗੇਮ ਖੇਡਦਾ ਨਾ ਤਾਂ ਉਹ ਤੰਦਰੁਸਤ ਰਹੂਗਾ ਤਾਂ ਵਧੀਆ ਹੈਗਾ ਹੈ ਨਾ ਅਤੇ ਜਿਵੇਂ ਹੈ ਨਾ ਜੇ ਛੋਟੇ ਛੋਟੇ ਬੱਚਿਆਂ ਦੀ ਗੱਲ ਕਰੀਏ ਨਾ ਵੀ ਉਨ੍ਹਾਂ ਵਾਸਤੇ ਦੌੜਨਾ ਛੋਟੇ ਬੱਚੇ ਕਿਉਂ ਹਰੇਕ ਬੰਦੇ ਲਈ ਕਿ ਦੌੜਨਾ ਮਤਲਬ ਵੀ ਸਿਹਤਮੰਦ ਰਹਿਣ ਵਿੱਚ ਬਹੁਤ ਮਦਦ ਕਰਦਾ ਹੈਗਾ ਕਿਉਂ ਜੇ ਦੇਖੋ ਜੇ ਆਪਾਂ ਦੌ ਦੌੜਾਂਗੇ ਹੈ ਨਾ ਆਪਣੇ ਵਧੀਆ ਸਰੀਰ ਸਾਰੇ ਅੰਗ ਪੈਰ ਹੈ ਨਾ ਸਹੀ ਕੰਮ ਕਰ ਕਰਨਗੇ ਹੈ ਨਾ ਸਰੀਰ 'ਚੋਂ ਪਸੀਨਾ ਨਿਕਲੂਗਾ ਹੈ ਨਾ ਤਾਂ ਆਪਣੇ ਜਿਹੜੇ ਸਰੀਰ ਦੇ ਸਾਰੇ ਜਿਹੜੇ ਹੱਡ ਪੈਰ ਨੇ ਹੈ ਨਾ ਵੀ ਉਹ ਵਧੀਆ ਖੁੱਲ੍ਹਦੇ ਨੇ ਹੈ ਨਾ ਆਪਣਾ ਜਿਹੜਾ ਦੇੜਾ ਅੱਡ ਦਾ ਜਿਹੜਾ ਵਹਾਅ ਹੈਗਾ ਉਹ ਵਧੀਆ ਤੇਜ਼ ਹੁੰਦਾ ਨਾ ਮਤਲਬ ਕੇ ਪੂਰਾ ਜਿਹੜਾ ਸਰੀਰ ਹੈਗਾ ਉਹ ਗਰਮ ਹੁੰਦਾ ਨਾ ਵੀ ਆਪਣੇ ਸਾਰੇ ਜਿਹੜੇ ਅੰਗ ਨੇ ਹੈ ਨਾ ਵੀ ਉਹ ਵਧੀਆ ਪ੍ਰੋਪਰ ਕੰਮ ਕਰਨ ਲੱਗ ਜਾਂਦੇ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਨੇ ਹੈ ਨਾ ਹੱਡੀਆਂ ਮਜ਼ਬੂਤ ਹੁੰਦੀਆਂ ਨੇ ਅਤੇ ਬੱਚਾ ਮਾਰ ਨਹੀਂ ਖਾਂਦਾ ਵੀ ਛੇਤੀ ਛੇਤੀ ਬਿਮਾਰ ਨਹੀਂ ਪੈਂਦਾ ਹੈਗਾ ਤਾਂ ਕਰਕੇ ਵੀ ਆਪਾਂ ਨੂੰ ਸਾਰਿਆਂ ਨੂੰ ਹੀ ਚਾਹੀਦਾ ਹੈਗਾ ਵੀ ਹੈ ਨਾ ਵੀ ਵੀ ਆਪਾਂ ਨੂੰ ਕੋਈ ਹਰੇਕ ਵੀ ਕੋਈ ਨਾ ਕੋਈ ਖੇਡ ਜ਼ਰੂਰ ਰੱਖਣੀ ਚਾਹੀਦੀ ਹੈ ਸੈਰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਕਿ ਆਪਾਂ ਮਾਨਸਿਕ ਤਣਾਅ ਤੋਂ ਵੀ ਬਚੇ ਰਹੀਏ ਅਤੇ ਅ ਸਿਹਤ ਪੱਖੋਂ ਤਾਂ ਆਪਾਂ ਤੰਦਰੁਸਤ ਰਹਾਂਗੇ ਹੀ ਰਹਾਂਗੇ